ਸਾਡੇ ਸਮਾਜ ਵਿੱਚ ਕਈ ਕਾਰੋਬਾਰ ਇੱਦਾਂ ਦੇ ਵੀ ਹਨ ਜਿਹਨਾਂ ਕਰਕੇ ਵਾਤਾਵਰਨ ਬਹੁਤ ਹੀ ਜ਼ਿਆਦਾ ਦੂਸ਼ਿਤ ਹੁੰਦਾ ਹੈ ਜਿਹਨਾਂ ਕਰਕੇ ਜਿਵੇਂ ਕਿ ਪਰਾਲੀ ਦਾ ਸਾੜਨਾ ਸੜਕਾਂ ਦੇ ਉੱਤੇ ਗੰਦਾ ਕੂੜਾ ਕਰਕਟ ਸੁੱਟਣਾ ਨਾਲੀਆਂ ਸੀਵਰੇਜ ਦਾ ਬਲੋਕ ਹੋਣਾ ਸੀਵਰਸ ਦਾ ਗੰਦਾ ਪਾਣੀ ਸੜਕਾਂ 'ਤੇ ਖੜ੍ਹਨਾ ਜਿਹਨਾਂ ਕਰਕੇ ਮੱਛਰ ਮੱਖੀਆਂ ਆਦਿ ਪੈਦਾ ਹੁੰਦੀਆਂ ਹਨ ਜਿਹਨਾਂ ਕਰਕੇ ਬੱਚਿਆਂ ਵੱਡਿਆਂ ਅਤੇ ਬਜ਼ੁਰਗਾਂ ਨੂੰ ਗੰਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਇਸ ਕਰਕੇ ਸਰਕਾਰ ਨੂੰ ਸੀਵਰੇਜ ਦੀ ਸਮੇਂ ਸਿਰ ਜਿਵੇਂ ਕਿ ਸੀਵਰੇਜ ਦੀ ਪਾਈਪ ਬਲੋਕ ਹੋਣ ਕਾਰਨ ਸੀਵਰੇਜ ਦੀ ਪਾਈਪ ਨੂੰ ਟਾਈਮ ਸਿਰ ਬਦਲ ਦੇਣਾ ਚਾਹੀਦਾ ਹੈ ਤਾਂ ਜੋ ਸੀਵਰੇਜ ਬਲੋਕ ਨਾ ਹੋ ਸਕਣ ਉਹਨਾਂ ਦਾ ਗੰਦਾ ਪਾਣੀ ਸੜਕਾਂ 'ਤੇ ਨਾ ਖੜ੍ਹ ਸਕੇ ਜਿਹਨਾਂ ਕਰਕੇ ਮੱਛਰ ਬਿਮਾਰੀਆਂ ਪੈਦਾ ਨਾ ਹੋਣ ਸਰਕਾਰ ਨੂੰ ਸੀਵਰੇਜ ਦੇ ਲਈ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਕਿ ਕਮੇਟੀ ਸਮੇਂ ਸਿਰ ਸੁਧਾਰ ਕਰ ਸਕੇ